ਮੁੱਝੇ ਮੈਨੂੰ ਬੁਣਾਈ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਹਰ ਤਰ੍ਹਾਂ ਦੀ ਬੁਣਾਈ ਕਰ ਸਕਦੀ ਹਾਂ ਪਰ ਇਸ ਦੌਰਾਨ ਮੈਨੂੰ ਸਵੈਟਰ ਬਹੁਤ ਅੱਛੇ ਲੱਗਦੇ ਹੈ ਮੈਂ ਆਪਣੇ ਬੱਚਿਆਂ ਲਈ ਵੀ ਸਵੈਟਰ ਬਣਾਏ ਹੋਏ ਪਰ ਅੱਜ ਕੱਲ੍ਹ ਦੇ ਬੱਚੇ ਇਹਨੂੰ ਪਾਉਂਦੇ ਨਹੀਂ ਪਰ ਫਿਰ ਵੀ ਮੇਰੇ ਬੱਚਿਆਂ ਨੂੰ ਮੇਰੇ ਹੱਥ ਦੇ ਬਣੇ ਹੋਏ ਸਵੈਟਰ ਬਹੁਤ ਅੱਛੇ ਲੱਗਦੇ ਹਨ ਪਰ ਸ ਇਨ੍ਹਾਂ ਸਭ ਚੀਜ਼ਾਂ ਹੀ ਬਹੁਤ ਅੱਛੀਆਂ ਹਨ ਟੋਪੀਆਂ ਦਾ ਵੀ ਇੱਕ ਆਪਣਾ ਹੀ ਅਲੱਗ ਰੂਪ ਹੁੰਦਾ ਹੈ ਟੋਪੀ ਆਪਣੇ ਆਪ ਇੱਕ ਅਲੱਗ ਹੀ ਜਗ੍ਹਾ ਲੈ ਲੈਂਦੀ ਹੈ ਪਰ ਮੈਨੂੰ ਹਰੇਕ ਚੀਜ਼ ਦਾ ਬਹੁਤ ਜ਼ਿਆਦਾ ਹੀ ਸ਼ੌਂਕ ਹੈ ਮੈਂ ਇਹ ਸਿਲਾਈ ਦੀ ਬੁਣਾਈ ਦੇ ਵਿੱਚ ਬਹੁਤ ਜ਼ਿਆਦਾ ਸ਼ੌਂਕ ਰੱਖਦੀ ਹਾਂ ਮੈਨੂੰ ਬੁਣਨਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਸੰਦ ਹੈ ਮੇਰੇ ਘਰ ਵਿੱਚ ਹੀ ਸਭ ਬੁਣਾਈ ਕਰਦੇ ਹੁੰਦੇ ਸੀ ਉਨ੍ਹਾਂ ਨੂੰ ਦੇਖ ਕੇ ਮੈਂ ਆਪਣੀ ਬੁਣਾਈ ਦਾ ਸ਼ੌਂਕ ਜਾਰੀ ਰੱਖਿਆ ਹੈ ਜਦੋਂ ਵੀ ਕਿਸੇ ਘਰ ਬੱਚਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੈਨੂੰ ਹੀ ਕਹਿ ਦਿੰਦੇ ਹੈ ਕਿ ਸਾਡੇ ਬੱਚੇ ਲਈ ਸਵੈਟਰ ਤੁਸੀਂ ਹੀ ਬਣਾਉਣਾ ਹੈ ਬੱਚਿਆਂ ਦੇ ਸਵੈਟਰ ਪਾਉਣ 'ਤੇ ਬੱਚਿਆਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਵੀ ਉਨਾਂ ਨੂੰ ਇਸ ਸਵੈਟਰਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਨਿੱਘ ਮਿਲ ਜਾਂਦਾ ਹੈ ਗਾ ਹੈ ਬੱਚਿਆਂ ਦੇ ਸਵੈਟਰਾਂ ਨਾਲੋਂ ਸਵੈਟਰ ਬਣਾਉਣ 'ਚ ਹੈ ਬਹੁਤ ਹੀ ਅੱਛੇ ਲੱਗਦਾ ਹੈ ਬਚ ਇਸ ਤਰ੍ਹਾਂ ਲੱਗਦਾ ਹੈ ਕਿ ਬੱਚਿਆਂ ਨੂੰ ਜਿਵੇਂ ਆਪਣਾ ਪਿਆਰ ਹੀ ਪਾ ਦਿੱਤਾ ਹੋਇਆ ਹੈ ਬੱਚਿਆਂ ਦੇ ਸਵੈਟਰਾਂ ਦੇ ਨਾਲ